ਭੰਗੜਾ ਐਰੋਬਿਕਸ ਲੋਕਾਂ ਨੇ ਬੜਾ ਹੀ ਦਿਲਚਸਪ ਵੀ ਬਣਾਤਾ ਹੈ ਕਿਉਂਕਿ ਭੰਗੜਾ ਜਦੋਂ ਭੰਗੜਾ ਐਰੋਬਿਕਸ ਕਰਦੇ ਹਾਂ ਤਾਂ ਲੋਕਾਂ ਨੂੰ ਲੱਗਦਾ ਅਸੀਂ ਅਸਲੀ ਭੰਗੜਾ ਕਰ ਰਹੇ ਹਾਂ ਜੋ ਕਿ ਆਪਾਂ ਸਭ ਨੂੰ ਪਤਾ ਕਿ ਬਹੁਤ ਹੀ ਖੁਸ਼ ਮਿਜ਼ਾਜ ਰੱਖਦਾ ਹੈ ਆਪਾਂ ਨੂੰ ਦੇਖ ਕੇ ਵੀ ਕਿੰਨੀ ਖੁਸ਼ੀ ਹੁੰਦੀ ਹੈ ਭੰਗੜਾ ਜਦੋਂ ਪੈਂਦਾ ਇਹ ਤਾਂ ਆਪਾਂ ਦੇਖਿਆ ਹੀ ਹੈ ਜਦੋਂ ਕਲਚਰਲ ਈਵੈਂਟਸ ਹੁੰਦੇ ਹੈ ਯੂਥ ਫੈਸਟ ਹੁੰਦਾ ਜਦੋਂ ਭੰਗੜਾ ਆਉਂਦਾ ਤਾਂ ਸਾਰੇ ਖੜ੍ਹੇ ਹੋ ਕੇ ਨੱਚਣ ਲੱਗ ਜਾਂਦੇ ਹੈ ਕਿਉਂਕਿ ਇਹ ਸਾਨੂੰ ਸਾਨੂੰ ਵਿਰਾਸਤ 'ਚ ਮਿਲਿਆ ਅਸੀਂ ਪੰਜਾਬ 'ਚ ਰਹਿੰਦੇ ਅਤੇ ਸਾਨੂੰ ਵਿਰਾਸਤ 'ਚ ਭੰਗੜਾ ਹੀ ਮਿਲਿਆ ਹੈ ਭੰਗੜਾ ਅਤੇ ਗਿੱਧਾ ਹੀ ਮਿਲਿਆ ਅਤੇ ਭੰਗੜਾ ਐਰੋਬਿਕਸ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਾਨੂੰ ਬ ਇਹ ਬਹੁਤ ਹੀ ਦਿਲਚਸਪ ਹੈ ਕਿਉਂਕਿ ਇਹ ਸਾਨੂੰ ਆਪਣੇ ਵਿਰਾਸਤ ਨਾਲ ਜੋੜੀ ਰੱਖਦਾ ਹੈ ਸਾਡੇ ਸੱਭਿਆਚਾਰ ਨਾਲ ਜੋੜੀ ਰੱਖਦਾ ਹੈ